ਸਾਡੇ ਸ਼ਹਿਰ ਮੋਹਾਲੀ ਦੀ ਬਹੁਤ ਮਸ਼ਹੂਰ ਆਈਟਮ ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਲੱਸੀ ਦੁੱਧ ਦਹੀਂ ਸਾਡੇ ਜੀਮੀਦਾਰ ਢਾਬੇ ਦਾ ਬਹੁਤ ਹੀ ਪ੍ਰਸਿੱਧ ਹੈ ਇੱਥੇ ਸਾਗ ਬਹੁਤ ਹੀ ਸਵਾਦਿਸ਼ਟ ਅਤੇ ਬਹੁਤ ਹੀ ਮੇਹਨ ਆਪਣੀ ਮਿਹਨਤ ਨਾਲ ਬਣਾਇਆ ਜਾਂਦਾ ਇੱਥੇ ਬਹੁਤ ਰਸ਼ ਹੋ ਜਾਂਦਾ ਹੈ ਕਈ ਵਾਰ ਤਾਂ ਨੰਬਰ ਹੀ ਨਹੀਂ ਆਉਂਦਾ ਖਾਣ ਪੀਣ ਦਾ ਸਾਗ ਨੂੰ ਆਪਣੇ ਤਰੀਕੇ ਨਾਲ ਤਿਆਰ ਕਰਦੇ ਹਨ ਘੋਟ ਕੇ ਵਿੱਚ ਮੱਕੀ ਦਾ ਆਟਾ ਹੋਰ ਕਈ ਆਈਟਮਾਂ ਪੈਂਦੀਆ ਹਨ ਜਿਸ ਨਾਲ ਸਾਗ ਬਹੁਤ ਹੀ ਸਵਾਦਿਸ਼ਟ ਹੋ ਜਾਂਦਾ ਹੈ ਲੱਸੀ ਲੱਸੀ ਜਿਵੇਂ ਆਪਣੇ ਘਰ ਦੇ ਦੁੱਧ ਦੀ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਦਹੀਂ ਦ ਦਹੀਂ ਵੀ ਆਪਣੇ ਘਰ ਦੇ ਦੁੱਧ ਨਾਲ ਤਿਆਰ ਕੀਤਾ ਜਾਂਦਾ ਹੈ ਇਹ ਆਪਣਾ ਢਾਬਾ ਜੀਮੀਦਾਰ ਮੋਹਾਲੀ ਬੱਸ ਸਟੈਂਡ ਅੱਡੇ ਖਰੜ੍ਹ ਦੇ ਵਿੱਚ ਹੈ ਜੋ ਬਹੁਤ ਮਸ਼ਹੂਰ ਹੈ ਇੱਥੇ ਖਾਣ ਪੀਣ ਨੂੰ ਬਹੁਤ ਹੀ ਕਈ ਆਈਟਮਾਂ ਹੋਰ ਵੀ ਮਿਲਦੀਆਂ ਹਨ ਜਿਵੇਂ ਮੱਕੀ ਦੀ ਰੋਟੀ ਹੋ ਗਈ ਹੋਰ ਕਣਕ ਦੀ ਰੋਟੀ ਹੋਰ ਸਰਸੋਂ ਦੀ ਰੋਟੀ ਹੈ ਹੋਰ ਕਈ ਆਈਟਮਾਂ ਜੋ ਬਹੁਤ ਹੈ ਮਸ਼ਹੂਰ ਖਾਣੇ ਪੀਣੇ ਵਾਲੀਆਂ ਉੱਥੇ ਜਾ ਕੇੇ ਪਤਾ ਲੱਗਦਾ ਹੈ ਉੱਥੇ ਰਸ਼ ਬਹੁਤ ਹੋਇਆ ਹੁੰਦਾ ਹੈ